ਸਤਿ ਸ਼੍ਰੀ ਅਕਾਲ ਮੇਰਾ ਨਾਮ ਪ੍ਰੀਆ ਹੈ ਅਤੇ ਮੈਂ ਅੱਜ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ ਜੋ ਮੇਰੇ ਨਾਲ ਅੱਜ ਹੋਈ ਮੇਰਾ ਅੱਜ ਇੱਕ ਪੇਪਰ ਸੀ ਜੋ ਕਿ ਦੂਸਰੇ ਸ਼ਹਿਰ ਵਿੱਚ ਸੀ ਅਤੇ ਉਸ ਸ਼ਹਿਰ ਦਾ ਮੈਨੂੰ ਕੁਝ ਇੰਨਾਂ ਪਤਾ ਨਹੀਂ ਸੀ ਅਤੇ ਮੈਂ ਜਾਣ ਵਾਲੀ ਵੀ ਇਕੱਲੀ ਸੀ ਅਤੇ ਮੈਨੂੰ ਗਾਈਡ ਕਰਨ ਵਾਲਾ ਵੀ ਉੱਥੇ ਕੋਈ ਨਹੀਂ ਸੀ ਜਿੱਦਾਂ ਜਿੱਦਾਂ ਤਾਂ ਮੈਂ ਉਸ ਸ਼ਹਿਰ ਉੱਤੇ ਪੁੱਜ ਗਈ ਬਟ ਬਟ ਮੇਰੇ ਨਾਲ ਕੀ ਹੋਇਆ ਮੈਨੂੰ ਉਸ ਉਥੋਂ ਦੀਆਂ ਲੋਕਲ ਗਲੀਆਂ ਦਾ ਨਹੀਂ ਸੀ ਪਤਾ ਜਿਸ ਸੈਂਟਰ ਉੱਤੇ ਮੈਂ ਜਾਣਾ ਸੀ ਅਤੇ ਮੈਂ ਕੀ ਕੀਤਾ ਮੇਰੇ ਇੱਕ ਦੋਸਤ ਨੇ ਮੈਨੂੰ ਦੱਸਿਆ ਸੀ ਕਿ ਉਹਨਾਂ ਤੋਂ ਤੁਸੀਂ ਇੱਕ ਰਾਈਡ ਬੁੱਕ ਕਰ ਸਕਦੇ ਹੋ ਅਤੇ ਉਹ ਤੁਹਾਨੂੰ ਸਹੀ ਜਗ੍ਹਾ 'ਤੇ ਪਹੁੰਚਾ ਸਕਦੇ ਹਨ ਮੈਨੂੰ ਪਹਿਲੇ ਤਾਂ ਇੰਨਾਂ ਵਿਸ਼ਵਾਸ ਨਹੀਂ ਸੀ ਬਟ ਮੇਰੇ ਕੋਲ ਕੋਈ ਹੋਰ ਚਾਰਾ ਵੀ ਨਹੀਂ ਸੀ ਇਸ ਕਰਕੇ ਮੈਂ ਓਲਾ ਤੋਂ ਗੱਡੀ ਬੁੱਕ ਕੀਤੀ ਅਤੇ ਉਹ ਸਹੀ ਸਮੇਂ 'ਤੇ ਮੈਨੂੰ ਲੈਣ ਆ ਗਏ ਅਤੇ ਮੈਂ ਉਹ 'ਤੇ ਬੈਠ ਗਈ ਅਤੇ ਮੈਂ ਗੂਗਲ ਮੈਪ 'ਤੇ ਆਪਣੀ ਲੋਕੇਸ਼ਨ ਲਗਾ ਲਈ ਜਿੱਥੇ ਮੈਂ ਜਾਣਾ ਸੀ ਅਤੇ ਡਰਾਈਵਰ ਨੂੰ ਵੀ ਮੈਂ ਦੱਸ ਦਿੱਤਾ ਸੀ ਕਿ ਮੈਂ ਇਸ ਸੈਂਟਰ 'ਤੇ ਜਾਣਾ ਹੈ ਅਤੇ ਡਰਾਈਵਰ ਪਹਿਲੇ ਤਾਂ ਮੈਨੂੰ ਥੋੜ੍ਹਾ ਅਜੀਬ ਲੱਗਿਆ ਬਟ ਜਦੋਂ ਉਹਦੇ ਨਾਲ ਗੱਲਬਾਤ ਹੋਈ ਤਾਂ ਉਹ ਬਹੁਤ ਹੀ ਵਧੀਆ ਇਨਸਾਨ ਸੀ ਉਸ ਨੇ ਜਦੋਂ ਮੈਨੂੰ ਉਸ ਨੂੰ ਦੱਸਿਆ ਕਿ ਮੈਂ ਥੋੜ੍ਹਾ ਲੇਟ ਹੋ ਰਹੀ ਹਾਂ ਤਾਂ ਉਸਨੇ ਕੀ ਕੀਤਾ ਉਸ ਨੇ ਸ਼ੋਰਟਕੱਟ ਲੈ ਲਿਆ ਅਤੇ ਮੈਨੂੰ ਸਮੇਂ ਤੋਂ ਪਹਿਲਾਂ ਹੀ ਉੱਥੇ ਪਹੁੰਚਾ ਦਿੱਤਾ ਜਿਸ ਕਰਕੇ ਮੈਂ ਆਪਣਾ ਪਾਈਪਰ ਜਿਹੜਾ ਹੈ ਉਹ ਸਮੇਂ ਸਿਰ ਦੇ ਸਕੀ ਜੇ ਇੱਦਾਂ ਨਾ ਹੁੰਦਾ ਤਾਂ ਮੈਨੂੰ ਐਂਟਰੀ ਤੋਂ ਕੱਢ ਦਿੱਤਾ ਜਾਣਾ ਸੀ ਪਰ ਉਸ ਡਰਾਈਵਰ ਦੀ ਵਜ੍ਹਾ ਨਾਲ ਮੈਂ ਆਪਣੇ ਸੈਂਟਰ 'ਤੇ ਸਮੇਂ ਸਿਰ ਪੁੱਜ ਸਕੀ ਇਸ ਕਰਕੇ ਮੈਨੂੰ ਉਸ ਡਰਾਈਵਰ ਦੀ ਮਦਦ ਬਹੁਤ ਹੀ ਮਦਦਗਾਰ ਹੋਈ ਅਤੇ ਮੈਂ ਉਸ ਡਰਾਈਵਰ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਉਸ ਦਾ ਨਾਮ ਸੀ ਚੰਦੂ